ਕਿਆ ਵਧੀਆ ਗੱਲ ਹੈ ਪੇਂਡੂ ਅਤੇ ਸ਼ਹਿਰੀ ਖੇਡਾਂ ਪੇਂਡੂ ਖੇਡਾਂ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਕਿਹਨੂੰ ਕਹਿੰਦੇ ਹੈ ਪੇਂਡੂ ਖੇਡਾਂ ਗੁੱਲੀ ਡੰਡਾ ਖਿੱਦੋਂ ਕਬੱਡੀ ਗੈਲਰੀ ਕਿੱਥੇ ਆ ਹੁਣ ਖਤਮ ਹੋ ਗਈਆਂ ਸ਼ਹਿਰੀ ਖੇਡਾਂ ਕੀ ਹੈ ਸ਼ਹਿਰੀ ਖੇਡਾਂ 'ਚ ਕੀ ਹੁੰਦਾ ਕਬੱਡ ਆਪਣਾ ਕਬੱਡੀ ਨੂੰ ਉਹੀ ਅਸੀਂ ਕਬੱਡੀ ਖੇਲਦੇ ਹਾਂ ਉਹਨੂੰ ਅਸੀਂ ਰੈਸਲਿੰਗ ਬਣਾ ਤਾ ਠੀਕ ਹੈ ਅਸੀਂ ਖਿੱਦੋਂ ਖੇਲਦੇ ਸੀ ਉਹਨੂੰ ਅਸੀਂ ਕ੍ਰਿਕ ਕ੍ਰਿਕਟ ਬਣਾ ਤਾ ਹੌਕੀ ਹੋ ਗਈ ਠੀਕ ਹੈ ਇਹ ਚੀਜ਼ਾਂ ਕੀ ਹੈ ਇਹ ਪੇਂਡੂ ਹੀ ਸ਼ਹਿਰੋ ਹੀ ਸ਼ਹਿਰੀ ਬਣ ਕੇ ਆਈਆਂ ਇਹ ਪਿੰਡਾਂ ਤੋਂ ਸ਼ੁਰੂ ਹੋ ਕੇ ਸ਼ਹਿਰਾਂ ਤੱਕ ਪਹੁੰਚੀਆਂ